ਸਾਡੇ ਏਰੀਏ 'ਚ ਆਮ ਕਰਕੇ ਦਸਮੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਸ ਅਤੇ ਸੰਗਰਾਂਦ ਮਨਾਈ ਜਾਂਦੀ ਹਰੇਕ ਮਹੀਨੇ ਅਤੇ ਸਾਲ ਦੇ ਵਿੱਚ ਇੱਕ ਵਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ